ਹੈਲੋ

ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਕੁਲਦੀਪਕ ਜੀ ਬੋਲ ਰਹੇ ਜੀ ਕਾਲਸੀ ਰਿਕੋਡ ਤੋਂ ਠੀਕ ਹੈ ਜੀ ਸਰ ਐਕਚੁਲੀ ਮੈਂ ਆਪਣੇ ਇੱਕ ਫਰੈਂਡ ਨਾਲ ਬੈਠਾ ਸੀ ਅਤੇ ਇੱਕ ਸੌਂਗ ਦੀ ਰਿਕੋਡਿੰਗ ਬਾਰੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਨਾਲ ਅਤੇ ਉਹ ਗੱਲਾਂ ਗੱਲਾਂ ਵਿੱਚ ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਕਿ ਕੁਲਦੀਪਕ ਜੀ ਮੇਰੇ ਸਰ ਮੇਰੇ ਮਿੱਤਰ ਹੈਗੇ ਹੈ ਇੰਦਰਪਾਲ ਜੀ ਅਤੇ ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਅਤੇ ਉਹ ਡੈਫੀਨੇਟਲੀ ਤੁਹਾਡੀ ਗੱਲ ਤਰੀਕ ਸੁਣਨਗੇ ਅੱਛੀ ਤਰ੍ਹਾਂ ਹੈਲਪ ਕਰਨਗੇ ਤੁਹਾਡੀ ਅਤੇ ਮੈਂ ਸਰ ਪੁੱਛਣਾ ਸੀ ਕਿ ਤੁਹਾਡਾ ਜਿਹੜਾ ਰਿਕੋਡੀਵ ਤੁਹਾਡੇ ਕੋਲ ਹੈ ਕੋਈ ਇੱਦਾਂ ਦਾ ਅੋਲਰੇਡੀ ਰਿਕੋਡਿਡ ਸੌਂਗ ਜਾਂ ਕੁਛ ਓਕੇ ਜੀ ਰਾਈਟ ਸਰ ਰਾਈਟ ਅਤੇ ਤੁਹਾਡਾ ਸਰ ਕਿੱਥੇ ਹੈਗਾ ਅੋਫਿਸ ਰਾਈਟ ਮੈਨੂੰ ਸਰ ਆਪਣੀ ਲੋਕੇਸ਼ਨ ਜਾਂ ਸਾਰਾ ਕੁਛ ਆਪਣਾ ਸ਼ੇਅਰ ਕਰ ਦੇਣਾ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਸਰ ਨੈਕਸਟ ਵੀਕ ਸੈਟਰਡੇ ਇੱਕ ਮਿਲ ਕੇ ਅਤੇ ਮੀਟਿੰਗ ਕਰਦੇ ਹਾਂ ਅਤੇ ਮੈਂ ਸੁਣ ਵੀ ਲਊਂਗਾ ਅਤੇ ਫਰਦਰ ਜੋ ਵੀ ਅਸੀਂ ਕਰਨਾ ਅਸੀਂ ਕਰ ਲਵਾਂਗੇ ਨਾ ਰਾਈਟ ਸਰ ਰਾਈਟ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਰ